ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਤੁਹਾਡਾ ਨੰਬਰ ਮੈਨੂੰ ਜੀ ਫਰੈਂਡ ਮੇਰੇ ਫਰੈਂਡ ਨੇ ਦਿੱਤਾ ਸੀਗਾ ਜੀ ਤੁਸੀਂ ਮੈਨੂੰ ਫਤਿਹਗੜ੍ਹ ਸਾਹਿਬ ਬਾਰੇ ਦੱਸ ਸਕਦੇ ਹੋ ਜੀ ਉੱਥੇ ਦੇ ਰੋਜ਼ ਗਾਰਡਨ ਬਾਰੇ ਅੱਛਾ ਜੀ ਹਾਂਜੀ ਮੈਂ ਜੀ ਆਮ ਖਾਸ ਬਾਗ ਸੁਣਿਆ ਸੀਗਾ ਅੱਛਾ ਜੀ ਜੇ ਜੀ ਮੈਂ ਕੁਝ ਹੋਰ ਪੁੱਛਣਾ ਹੋਇਆ ਮੈਂ ਤੁਹਾਨੂੰ ਫੋਨ ਕਰ ਲੂੰਗੀ ਠੀਕ ਹੈ ਜੀ ਅੱਛਾ ਠੀਕ ਹੈ ਜੀ